ਮੈਂ ਹਮੇਸ਼ਾਂ ਐਂਡਰੋਇਡ ਫੋਨ ਹੀ ਯੂਸ ਕੀਤਾ ਅਤੇ ਲਾਸਟ ਇੱਕ ਸਾਲ ਤੋਂ ਮੈਂ ਆਈਫੋਨ ਯੂਸ ਕਰ ਰਹੀ ਹਾਂ ਮੇਰੇ ਅਕੋਡਿੰਗ ਜੋ ਮੇਰਾ ਐਕਸਪੀਰੀਅੰਸ ਹੈ ਮਤਲਬ ਆਈਫੋਨ ਬੈਸਟ ਹੈ ਸਭ ਤੋਂ ਐਂਡਰੋਇਡ ਫੋਨਸ ਤੋਂ ਤਾਂ ਬਹੁਤ ਜ਼ਿਆਦਾ ਬੈਸਟ ਹੈ ਔਰ ਇਸ 'ਚ ਸਭ ਤੋਂ ਅੱਛੀ ਚੀਜ਼ ਜੋ ਹੈ ਮਤਲਬ ਕੋਈ ਥਰਡ ਪਰਸਨ ਸਾਡੇ ਫੋਨ 'ਚ ਰਿਕੋਡਿੰਗ ਜਾਂ ਕੋਈ ਵੀ ਚੀਜ਼ ਮਤਲਬ ਕ ਸਾਡੀ ਪਰਮੀਸ਼ਨ ਤੋਂ ਬਿਨਾਂ ਚਾਹੇ ਉਹ ਫੇਸ ਆਈ ਡੀ ਹੈ ਚਾਹੇ ਕੋਈ ਪਾਸਵਰਡ ਹੈ ਮਤਲਬ ਸਾਡੀ ਪਰਮੀਸ਼ਨ ਤੋਂ ਬਿਨਾਂ ਕੋਈ ਸਾਡੇ ਫੋਨ 'ਚ ਕੋਈ ਵੀ ਐਪ ਡਾਊਨਲੋਡ ਨਹੀਂ ਕਰ ਸਕਦਾ ਠੀਕ ਹੈ ਔਰ ਐਂਡਰੋਇਡ ਫੋਨ 'ਚ ਸਾਨੂੰ ਪਤਾ ਹੀ ਨਹੀਂ ਹੁੰਦਾ ਸਾਡੇ ਫੋਨ 'ਚ ਕੌਣ ਐਪ ਡਾਊਨਲੋਡ ਕਰ ਦਿੰਦਾ ਕੋਲ ਰਿਕੋਡਿੰਗਸ ਹੋ ਰਹੀਆਂ ਮਤਲਬ ਬੈਸਟ ਹੈ ਆਈਫੋਨ ਉਸ 'ਚ ਕੋਈ ਸਾਡੀ ਪ੍ਰਾਈਵੇਸੀ ਨੂੰ ਉਹ ਨਹੀਂ ਕਰ ਸਕਦਾ ਮਤਲਬ ਖਰਾਬ ਨਹੀਂ ਕਰ ਸਕਦਾ ਲੀਕ ਨਹੀਂ ਕਰ ਸਕਦਾ ਔਰ ਇਸ ਤੋਂ ਇਲਾਵਾ ਮੇਰੇ ਮੈਨੂੰ ਆਪਣੇ ਅਕੋਡਿੰਗ ਮੇਰੇ ਹੱਥ 'ਚ ਜੋ ਸਭ ਤੋਂ ਬੈਸਟ ਲੱਗਦਾ ਆਈਫੋਨ ਥਰਟੀਨ ਹੈ ਮੇਰੇ ਕੋਲ ਮਤਲਬ ਉਹਦਾ ਸਾਈਜ਼ ਲੁੱਕ ਵਾਈਜ਼ ਬਹੁਤ ਅੱਛਾ ਔਰ ਕੈਮਰਾ ਬਹੁਤ ਅੱਛਾ ਹੈ ਮੇਰੇ ਫੋਨ ਦਾ ਮਤਲਬ ਆਈਫੋਨ ਦਾ ਔਰ ਇਸ ਤੋਂ ਇਲਾਵਾ ਜਿੱਦਾਂ ਅਸੀਂ ਐਂਡਰੋਇਡ ਫੋਨ 'ਚ ਕੋਈ ਵੀ ਚੀਜ਼ ਫੋਟੋਜ਼ ਹੋਗੀਆਂ ਕੁਛ ਵੀ ਹੈ ਬਲੂਟੂਥ ਤੋਂ ਜਾਂ ਕਿਸੇ ਵੀ ਚੀਜ਼ ਤੋਂ ਆਪਾਂ ਸ਼ੇਅਰ ਕਰ ਦਿੰਦੇ ਦੂਸਰੀ ਦੇ ਫੋਨ 'ਤੇ ਆਈਫੋਨ 'ਚ ਮਤਲਬ ਕੁਛ ਵੀ ਆਪਾਂ ਸ਼ੇਅਰ ਨਹੀਂ ਕਰ ਸਕਦੇ ਕੋਈ ਵਾਇਰਸ ਨਹੀਂ ਆਉਂਦਾ ਕੁਛ ਨਹੀਂ ਆਉਂਦਾ ਮਤਲਬ ਬੈਸਟ ਹੈ ਹਰ ਪੱਖ ਤੋਂ ਨਾ